ਹਾਂਜੀ ਅਸੀਂ ਸੂਟ ਦਾ ਨਾਪ ਇੰਚੀਟੇਪ ਨਾਲ ਲੈਂਦੇ ਐਂ ਉਹਨੂੰ ਸਿੱਧਾ ਖੜਾਉਂਦੇ ਐਂ ਸੂਟ ਦੀ ਲੰਬਾਈ ਅਸੀਂ ਦੇਖਦੇ ਐਂ ਵੀ ਕਿੰਨੀ ਐ ਫਿਰ ਲੰਬਾਈ ਤੋਂ ਬਾਅਦ ਅਸੀਂ ਫਿਰ ਉਹਦਾ ਘੇਰਾ ਨਾਪਦੇ ਐਂ ਫਿਰ ਉਹਦੀ ਹਿਪ ਨਾਪਦੇ ਐਂ ਫਿਰ ਉਹਦੀ ਛਾਤੀ ਨਾਪਦੇ ਐਂ ਵੀ ਕਿੰਨੇ ਇੰਚ ਹੈ ਫਿਰ ਉਹਦਾ ਮਗਰ ਤੀਰਾ ਦੇਖਦੇ ਕਿੰਨੇ ਇੰਚ ਹੈ ਉਦੂੰ ਬਾਅਦ ਅਸੀਂ ਬਾਂਹ ਦੇਖਦੇ ਐਂ ਜੀ ਅੱਧੀ ਕਰਨੀ ਹੈ ਕਿ ਪੂਰੀ ਕਰਨੀ ਹੈ ਉਹ ਨਾਪਦੇ ਐਂ ਉਹ ਨਾਪ ਕੇ ਫਿਰ ਅਸੀਂ ਜੀ ਕਟਿੰਗ ਕਰਦੇ ਹਾਂ ਫਿਰ ਅਸੀਂ ਮੂਹਰੀ ਦੀ ਦੇਖਦੇ ਹੈ ਵੀ ਮੂਹਰੀ ਉਹਦੀ ਕਿੰਨੀ ਰੱਖਣੀ ਹੈ ਹੈਂ ਜਿਹੜੀ ਅਸੀਂ ਸੂਟ ਦਾ ਸਲਵਾਰ ਹੈ ਉਹਦੀ ਨਾਪ ਲੈਦੇ ਐਂ ਕਿੰਨੀ ਲੰਬਾਈ ਹੈ ਕਿੰਨੀ ਨਾ ਫਿਰ ਅਸੀਂ ਮੂਹਰੀ ਕਰਦੇ ਹਾਂ ਮੂਹਰੀ ਕਰਕੇ ਜੇ ਅਸੀਂ ਕਾਲਰ ਵਾਲਾ ਬਣਾਉਣਾ ਏ ਤਾਂ ਕਾਲਰ ਨਾਪਕ ਦੇ ਹੈ ਨਹੀਂ ਫਿਰ ਗਲਾ ਨਾਪ ਦੇ ਐਂ

ਸਾਰਾ ਕੁਛ ਕਰਕੇ ਜੀ ਕਟਾਈ ਫਿਰ ਕਰਦੇ ਹਾਂ ਅਸੀ ਫਿਰ ਕਰਕੇ ਫਿਰ ਉਹਦੀ ਸਿਲਾਈ ਕਰਦੇ ਹਾਂ ਫਿਰ ਸਿਲਾਈ ਕਰਕੇ ਫਿਰ ਉਹਨੂੰ ਫਿਰ ਪ੍ਰੈਸ ਕਰਦੇ ਹਾਂ ਪ੍ਰੈਸ ਕਰਕੇ ਪ੍ਰੈਸ ਕਰਕੇ ਅਤੇ ਅਗਲਿਆਂ ਤੈਅ ਮਾਰ ਕੇ ਫਿਰ ਅਗਲੇ ਨੂੰ ਗਾਹਕ ਨੂੰ ਅਸੀਂ ਕੱਪੜਾ ਦੇ ਦੇਂਦੇ ਹਾਂ